ਹੈਲੋ ਸਤਿ ਸ਼੍ਰੀ ਅਕਾਲ ਮੈਮ ਮੈਂ ਮੀਨਾਕਸ਼ੀ ਬੋਲਦੀ ਪਈ ਹਾਂ ਅਤੇ ਮੈਂ ਅੰਮ੍ਰਿਤਸਰ ਤੋਂ ਪਠਾਨਕੋਟ ਪਠਾਨਕੋਟ ਘੁੰਮਣ ਆਈ ਹਾਂ ਅਤੇ ਮੈਂ ਫੂਡ ਵਲੋਗਰ ਹਾਂ ਤੁਸੀਂ ਮੈਨੂੰ ਦੱਸ ਸਕਦੇ ਹੋ ਤੁਹਾਡੇ ਪਠਾਨਕੋਟ ਵਿੱਚ ਵਧੀਆ ਬੇਕਰੀ ਕਿਹੜੀ ਹੈ ਜਿੱਥੇ ਫਰੈਸ਼ ਪੈਟੀ ਪੈਟੀ ਬਰਗਰ ਵਗੈਰਾ ਮਿਲਦੇ ਹੋਣ ਹਾਂਜੀ ਕਿੱਥੇ ਦੀ ਮੈਮ ਹਾਂਜੀ ਹਾਂਜੀ ਮੈਮ ਟਾਈਮਿੰਗ ਕੀ ਹੈ

ਹਾਂਜੀ ਮੈਮ ਫਰੈਸ਼ ਫਰੂ ਫੂਡ ਹੁੰਦਾ ਓਕੇ ਮੈਮ ਥੈਂਕ ਯੂ